ਕ੍ਰਿਕਟ ਮੇਰੀ ਮਨਪਸੰਦ ਖੇਡ ਹੈ ਅਤੇ ਇਹ ਖੇਡ ਮੈਂ ਹਰ ਵੇਲੇ ਅਤੇ ਹਰ ਸਮੇਂ ਖੇਡਣਾ ਪਸੰਦ ਕਰਦਾ ਹਾਂ ਕਿਉਂਕਿ ਇਹ ਖੇਡ ਖੇਡਣ ਨਾਲ ਮੇਰਾ ਸਰੀਰ ਬਹੁਤ ਹੀ ਤੰਦਰੁਸਤ ਅਤੇ ਤਾਕਤਵਰ ਅਤੇ ਫੁਰਤੀਲਾ ਰਿਹਾ ਹੈ ਕ੍ਰਿਕਟ ਖੇਡਣ ਨਾਲ ਮੈਂ ਹਮੇਸ਼ਾ ਫੁਰਤੀ 'ਚ ਰਿਹਾਂ ਹਾਂ ਕ੍ਰਿਕਟ ਕ੍ਰਿਕਟ ਵਿੱਚ ਕਈ ਵਿਦਿਆਰਥੀਆਂ ਨੇ ਅਤੇ ਕਈ ਭਾਰਤ ਵਾਸੀਆਂ ਨੇ ਆਪਣਾ ਨਾਮ ਭਰਪੂਰ ਰੋਸ਼ਨ ਕਰਾਇਆ ਹੈ ਕ੍ਰਿਕਟ ਖੇਡਣ ਨਾਲ ਸਾਡਾ ਦਿਮਾਗ ਵੀ ਬਹੁਤ ਤੇਜ਼ ਦੌੜਦਾ ਹੈ ਅਤੇ ਹਾ ਸਾਡੇ ਸਰੀਰ ਦੀ ਸਾਰੀ ਆਂ ਆਂਦਰੀਆਂ ਭਰਪੂਰ ਕੰਮ ਕਰਦੀਆਂ ਹਨ ਕਿਉਂਕਿ ਇਸ ਇਸ ਗੇਮ ਵਿੱਚ ਇਸ ਖੇਡ ਵਿੱਚ ਸਿਰਫ਼ ਦੌੜਨ ਦਾ ਅਤੇ ਦਿਮਾਗ ਦਾ ਹੀ ਕੰਮ ਹੁੰਦਾ ਹੈ ਕ੍ਰਿਕਟ ਵਿੱਚ ਕਈ ਭਾਰਤ ਦੇ ਖਿਡਾਰੀਆਂ ਨੇ ਆਪਣਾ ਅਤੇ ਆਪਣੇ ਘਰਦਿਆਂ ਦਾ ਅਤੇ ਆਪਣੇ ਭਾਰਤ ਦਾ ਨਾਮ ਬਹੁਤ ਹੀ ਜ਼ਿਆਦਾ ਰੋਸ਼ਨ ਕੀਤਾ ਹੈ ਅਤੇ ਕ੍ਰਿਕਟ ਖੇਡਣ ਨਾਲ ਕ੍ਰਿਕਟ ਖੇਡਣ ਨਾਲ ਉਹਨਾਂ ਦਾ ਬਹੁਤ ਹੀ ਸਨਮਾਨ ਅਤੇ ਸਤਿਕਾਰ ਕੀਤਾ ਗਿਆ ਹੈ ਕ੍ਰਿਕਟ ਮੈਨੂੰ ਹਮੇਸ਼ਾ ਹੀ ਪਸੰਦ ਅਤੇ ਚੰਗਾ ਲੱਗਿਆ ਹੈ ਕ੍ਰਿਕਟ ਮੈਂ ਦੂਜੀ 'ਚ ਮੈਂ ਦੂਜੀ ਜਮਾਤ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਇਹ ਖੇਡ ਮੈਂ ਆਪਣੇ ਪਿਤਾ ਅਤੇ ਆਪਣੇ ਭਰਾ ਦੇ ਨਾਲ ਖੇਡਣੀ ਸ਼ੁਰੂ ਕੀਤੀ ਸੀ ਅਤੇ ਇਹ ਇਹਨਾਂ ਦੋਨਾਂ ਨੇ ਹੀ ਮੈਨੂੰ ਅੱਜ ਕ੍ਰਿਕਟ ਵਿੱਚ ਬਹੁਤ ਹੀ ਨਾ ਚੰਗਾ ਨਾਮ ਰੋਸ਼ਨ ਕਰਨ ਲਈ ਮੈਨੂੰ ਸਿਖਾਇਆ ਮੈਨੂੰ ਚੰਗਾ ਨਾਮ ਰੋਸ਼ਨ ਕਰਨ ਲਈ ਹੀ ਕ੍ਰਿਕਟ ਵਿੱਚ ਪਾਇਆ ਹੈ ਅਤੇ ਕ੍ਰਿਕਟ ਮਨਪਸੰਦ ਖੇਡ ਹੈ ਅਤੇ ਇਹ ਖੇਡ ਮੈਂ ਹਰ ਵੇਲੇ ਅਤੇ ਹਰ ਸਮੇਂ ਖੇਡਣਾ ਪਸੰਦ ਕਰਦਾ ਹਾਂ